ਯੋਗ ਜਿਸ ਨੂੰ ਕਿ ਪੁਰਾਤਨ ਇਤਿਹਾਸ ਦੇ ਵਿੱਚ ਪੁਰਾਤਨ ਸਮੇਂ ਦੇ ਵਿੱਚ ਸਿਹਤਮੰਦ ਰਹਿਣ ਦਾ ਅਤੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਨ ਦਾ ਇੱਕ ਬਹੁਤ ਹੀ ਵਧੀਆ ਅਭਿਆਸ ਜਿਹੜਾ ਮੰਨਿਆ ਜਾਂਦਾ ਸੀ ਸੋ ਪੁਰਾਤਨ ਸਮਿਆਂ ਤੋਂ ਬਾਅਦ ਅੱਜ ਦੁਬਾਰਾ ਫਿਰ ਅਜੋਕੇ ਸਮੇਂ ਦੇ ਵਿੱਚ ਲੋਕ ਇਸ ਯੋਗ ਪ੍ਰਣਾਲੀ ਨੂੰ ਬਹੁਤ ਜਿਆਦਾ ਮਹੱਤਵ ਦੇਣ ਲੱਗ ਗਏ ਨੇ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਪੱਛਮੀ ਦੇਸ਼ਾਂ ਦੇ ਵਿੱਚ ਵੀ ਅੱਜ ਯੋਗ ਪ੍ਰਣਾਲੀ ਨੂੰ ਅਪਣਾਇਆ ਜਾ ਰਿਹਾ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਇਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਅੱਜ ਸ਼ਹਿਰ ਸ਼ਹਿਰ ਪਿੰਡ ਪਿੰਡ ਯੋਗਾ ਦੇ ਅਭਿਆਸ ਦੇ ਲਈ ਕਲਾਸਾਂ ਲਗਾਈਆਂ ਜਾ ਰਹੀਆਂ ਨੇ ਸਰਕਾਰਾਂ ਇਸ ਦੇ ਲਈ ਖਾਸ ਤੌਰ ਤੇ ਜੋ ਉਪਰਾਲੇ ਕਰ ਰਹੀਆਂ ਨੇ ਤਾਂ ਕਿ ਲੋਕ ਯੋਗ ਦੇ ਨਾਲ ਜੁੜਨ ਅਤੇ ਸਿਹਤ ਮੰਦ ਰਹਿਣ ਅਤੇ ਪੁਰਾਤਨ ਇਸ ਪ੍ਰਣਾਲੀ ਤੋਂ ਲਾਭ ਉਠਾ ਸਕਣ ਇਸ ਪ੍ਰਣਾਲੀ ਦੇ ਤਹਿਤ ਮੈਂ ਵੀ ਯੋਗ ਆਸਨ ਕਰਨ ਤੋਂ ਬਾਅਦ ਜੋ ਆਪਣਾ ਮਾਨਸਿਕ ਤੇ ਸਰੀਰਕ ਮੈਨੂੰ ਲਾਭ ਪਹੁੰਚ ਰਿਹਾ ਹੈ ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਕਿ ਇਸ ਦੇ ਨਾਲ ਇਸ ਜੋਗ ਆਸਨ ਕਰਨ ਤੋਂ ਬਾਅਦ ਮੇਰੇ ਮਨ ਨੂੰ ਪੂਰਨ ਤੌਰ ਤੇ ਸ਼ਾਂਤੀ ਮਿਲਦੀ ਹੈ ਸਰੀਰ ਦੇ ਵਿੱਚ ਚੰਗੇ ਭਾਵਨਾਵਾਂ ਚੰਗੀਆਂ ਸੋਚ ਸੋਚਾਂ ਦਾ ਸੰਚਾਰ ਹੁੰਦਾ ਹੈ ਇਸ ਨਾਲ ਸਭ ਤੋਂ ਵੱਡੀ ਗੱਲ ਹੈ ਜੋ ਮੇਰਾ ਸਟੈਮਿਨਾ ਹੈ ਜੋ ਮੇਰਾ ਸਟੈਮਿਨਾ ਲਗਾਤਾਰ ਵਧਦਾ ਜਾ ਰਿਹਾ ਹੈ ਸਾਰਾ ਦਿਨ ਜੋ ਹੈ ਸਮਾਨ ਤੁਹਾਨੂੰ ਆਨੰਦ ਜੋ ਪ੍ਰਦਾਨ ਹੁੰਦਾ ਹੈ ਸੋ ਯੋਗਾ ਕਰਨ ਦੇ ਨਾਲ ਸਰੀਰ ਨੂੰ ਅਨੇਕਾਂ ਪ੍ਰਕਾਰ ਦੇ ਲਾਭ ਜੋ ਪ੍ਰਾਪਤ ਹੋ ਰਹੇ ਨੇ ਸੋ ਯੋਗਾ ਕਰਨ ਤੋਂ ਪਹਿਲਾਂ ਅਤੇ ਅੱਜ ਯੋਗਾ ਕਰਨ ਤੋਂ ਬਾਅਦ ਮੈਂ ਆਪਣੇ ਸਰੀਰ ਦੇ ਵਿੱਚ ਇੱਕ ਨਵੀਂ ਚੁਸਤੀ ਫੁਰਤੀ ਜੋ ਐ ਅਨੁਭਵ ਕਰ ਰਿਹਾ ਹਾਂ ਸੋ ਸਭ ਨੂੰ ਅਪੀਲ ਹੈ ਕਿ ਇਸ ਯੋਗ ਪ੍ਰਣਾਲੀ ਦੇ ਨਾਲ ਜੁੜਨ ਦੀ ਵੱਧ ਤੋਂ ਵੱਧ ਕੋਸ਼ਿਸ਼ ਕੀਤੀ ਜਾਵੇ ਧੰਨਵਾਦ